ਛੱਬੀ ਜਨਵਰੀ ਉੱਨੀ ਸੌ ਸੱਠ ਪੰਦਰਾਂ ਦਸੰਬਰ ਦੋ ਹਜ਼ਾਰ ਵੀਹ ਇੱਕ ਮਈ ਦੋ ਹਜ਼ਾਰ ਅੱਠ ਬਾਈ ਜਨਵਰੀ ਉੱਨੀ ਸੌ ਤਰਾਨਵੇਂ ਅਠਾਰਾਂ ਜੂਨ ਉੱਨੀ ਸੌ ਅੱਠ